ਬਹੁਤ ਹੀ ਪ੍ਰਕਾਰ ਦੀਆਂ ਕਸਰਤਾਂ ਹੁੰਦੀਆਂ ਹਨ ਉਹਨਾਂ ਵਿੱਚੋਂ ਮੈਨੂੰ ਦੌੜਨਾ ਬਹੁਤ ਪਸੰਦ ਹੈ ਦੌੜ ਇੱਕ ਇਹੋ ਜਿਹੀ ਚੀਜ਼ ਹੈ ਜਿਸ ਨਾਲ ਸਭ ਤੋਂ ਜ਼ਿਆਦਾ ਕੈਲੋਰੀ ਖਪਤ ਹੁੰਦੀ ਹੈ ਅਤੇ ਸਰੀਰ ਦੇ ਸਾਰੇ ਅੰਗ ਲਗਾਤਾਰ ਬੰਦੇ ਦੇ ਚਲਦੇ ਰਹਿੰਦੇ ਹਨ ਇਸ ਲਈ ਜੋ ਦੌੜ ਹੈ ਉਸਦੇ ਸੰਬੰਧੀ ਜਦੋਂ ਦੌੜ ਕਰਦੇ ਹਾਂ ਤਾਂ ਬਹੁਤ ਸਾਰੇ ਚੁਟਕਲੇ ਜਾਂ ਮੇਮਜ ਇੱਕ ਦੂਜੇ ਨਾਲ ਕੀਤੇ ਜਾਂਦੇ ਹਨ ਇੱਕ ਵਾਰ ਦੀ ਕਹਾਣੀ ਯਾਦ ਹੈ ਮੈਂ ਦੋ ਹਜ਼ਾਰ ਅਠਾਰਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਮੈਗਾ ਮੈਰਾਥੋਨ ਕਰਵਾਈ ਗਈ ਸੀ ਗਿੱਦੜਬਾਹਾ ਸ਼ਹਿਰ ਦੇ ਵਿੱਚ ਜਦੋਂ ਉੱਥੋਂ ਦੁਨੀਆਂ ਭਰ ਤੋਂ ਬਹੁਤ ਫੇਮਸ ਜਾਂ ਮਸ਼ਹੂਰ ਕੀਨੀਅਨ ਓਲੰਪੀਅਨ ਮੈਰਾਥਨ ਰਨਰਸ ਵੀ ਪਹੁੰਚੇ ਹੋਏ ਸੀ ਤਾਂ ਅਸੀਂ ਕੁੱਲ ਉਸ ਉਸ ਵਿੱਚ ਇੱਕ ਹਜ਼ਾਰ ਬੰਦੇ ਨੇ ਭਾਗ ਲਿਆ ਸੀ ਉਸ ਦਾ ਖੇਤਰਫਲ ਸਾਰਾ ਸੋਲ੍ਹਾਂ ਕਿਲੋਮੀਟਰ ਦੀ ਮੈਰਾਥੋਨ ਸੀ ਜਿਸ ਵਿੱਚ ਅਸੀਂ ਜਦੋਂ ਇੱਕ ਦੂਜੇ ਨੂੰ ਕਰੋਸ ਕਰਦੇ ਸੀ ਤਾਂ ਥਮਸ ਡਾਊਨ ਦਾ ਸਾਈਨ ਦੇ ਦਿੰਦੇ ਸੀ ਅਤੇ ਜਾਂ ਕਿਸੇ ਵੀ ਤਰ੍ਹਾਂ ਨਾਲ ਉਸ ਨੂੰ ਸ਼ਰਾਰਤ ਕਰਕੇ ਕਰੋਸ ਕਰਦੇ ਸੀ ਅਤੇ ਇਸ ਲਈ ਮੈਂ ਆਪਣੀ ਜ਼ਿੰਦਗੀ ਵਿੱਚ ਉਹ ਪਲ ਨੂੰ ਬਹੁਤ ਯਾਦ ਕਰਦਾ ਹਾਂ ਜਦੋਂ ਮੈਰਾਥੋਨ ਲਾਉਂਦੇ ਹੁੰਦੇ ਸੀ ਅਤੇ ਅਸੀਂ ਇੱਕ ਦੂਜੇ ਨੂੰ ਕਰੋਸ ਕਰਨ ਲੱਗੇ ਮੇਮਸ ਕਰਨਾ ਕਰੋਸ ਕਰੋਸ ਕਰਨ ਲੱਗੇ ਉਂਗਲਾਂ ਦੇ ਇਸ਼ਾਰੇ ਨਾਲ ਕ੍ਰੋਸ ਕਰ ਦੇਣਾ ਮੈਂ ਤੈਨੂੰ ਪਿੱਛੇ ਛੱਡ ਦਿੱਤਾ ਗਿਆ ਜਾਂ ਚੁਟਕੀ ਦੇ ਦੇਣੀ ਵੀ ਹਾਂ ਬਈ ਭੱਜ ਭੱਜ ਕਿਵੇਂ ਪਿੱਛੇ ਰਹਿ ਗਿਆ ਖਤਮ ਹੋ ਗਈ ਸਰੀਰ 'ਚੋਂ ਜਾਨ ਇਸ ਤਰੀਕੇ ਨਾਲ ਬਹੁਤ ਤਰ੍ਹਾਂ ਦੇ ਚੁਟਕਲੇ ਜਿਹੜੇ ਅਸੀਂ ਵਰਤਦੇ ਹਾਂ ਅਤੇ ਮਿਹਨਤ ਦੇ ਵਿੱਚ ਪਾਣੀ ਪੀਣ ਦੇ ਦੌਰਾਨ ਵੀ ਅਸੀਂ ਅੰਗੂਠੇ ਨੂੰ ਉੱਪਰ ਕਰਕੇ ਮੂੰਹ ਵੱਲ ਇਸ਼ਾਰਾ ਕਰਦੇ ਹਨ ਵੀ ਸਾਨੂੰ ਪਾਣੀ ਜ਼ਰੂਰਤ ਹੈ ਇਸ ਤਰੀਕੇ ਦੇ ਸਾਈਨ ਵਰਦੇ ਜਾਂਦੇ ਹਨ ਅਤੇ ਜਦੋਂ ਅਸੀਂ ਕਿਸੇ ਨੂੰ ਕਰੋਸ ਕਰਨ ਦਾ ਕਿਸੇ ਨੂੰ ਕਹਿਣਾ ਹੋਵੇ ਤਾਂ ਉਸਨੂੰ ਉਂਗਲਾਂ ਨਾਲ ਹੀ ਇਸ਼ਾਰਾ ਕਰਦੇ ਹਾਂ ਕਿ ਚੱਲ ਬਈ ਤੂੰ ਹੁਣ ਰੇਸ ਫੜ ਇਹਨੂੰ ਆਪਾਂ ਪਿੱਛੇ ਕਰਨਾ ਹੈ ਤਾਂ ਐਂਡ ਦੇ ਦੌਰਾਨ ਬਸ ਜਦੋਂ ਰੇਸ ਖਤਮ ਹੋਣ ਵਾਲੀ ਹੁੰਦੀ ਹੈ ਤਾਂ ਉਦੋਂ ਅਸੀਂ ਆਪਣੀਆਂ ਦੋਵੇਂ ਬਾਹਾਂ ਫੈਲਾ ਕੇ ਤਾਂ ਰੀਬਨ ਕੱਟਦੇ ਹਾਂ ਅਤੇ ਇਸ ਤਰ੍ਹਾਂ ਰਨਿੰਗ ਮੈਰਾਥੋਨ ਮੇਰੀ ਜ਼ਿੰਦਗੀ ਵਿੱਚ ਬਹੁਤ ਪਸੰਦੀਦਾ ਖੇਡ ਰਹੀ ਹੈ ਅਤੇ ਮੈਂ ਇਸ ਨੂੰ ਬਖੂਬੀ ਨਾਲ ਕਦੋਂ ਵੀ ਰਨਿੰਗ ਕਰਕੇ ਆਪਦਾ ਸਰੀਰ ਸਿਹਤਮੰਦ ਰੱਖ ਸਕਦਾ ਹਾਂ